ਕਿਸੇ ਵੀ ਟੈਕਨੋਲੋਜੀ ਦੀ ਵਰਤੋਂ ਨਾ ਕਰਨਾ ਮੈਨੂੰ ਸਮੇਂ ਵਿੱਚ ਬਹੁਤ ਪਿੱਛੇ ਉਸ ਵਕਤ ਵਿੱਚ ਲੈ ਜਾਂਦਾ ਹੈ ਜਦੋਂ ਘਰ ਵਿੱਚ ਬਿਜਲੀ ਮੌਜੂਦ ਨਹੀਂ ਹੁੰਦੀ ਸੀ ਸਾਰਾ ਪਰਿਵਾਰ ਬਾਹਰ ਵਿਹੜੇ ਵਿੱਚ ਲੱਗੇ ਦਰਖ਼ਤ ਦੇ ਥੱਲੇ ਬੈਠਦਾ ਸੀ ਗਰਮੀ ਬਹੁਤ ਹੈ ਧੁੱਪ ਵੀ ਤੇਜ ਹੈ ਪਰ ਪੇੜ ਦੀ ਛਾਂ ਇੰਨੀ ਠੰਢੀ ਹੈ ਹਵਾ ਇੰਨੀ ਸੋਹਣੀ ਚੱਲ ਰਹੀ ਹੈ ਕਿ ਉਹ ਗਰਮੀ ਮਹਿਸੂਸ ਨਹੀਂ ਹੋ ਰਹੀ ਖਾਣਾ ਬਣਾਉਣ ਦਾ ਵਕਤ ਹੁੰਦਾ ਹੈ ਮੈਂ ਉੱਠਦੀ ਹਾਂ ਅਤੇ ਚੁੱਲੇ 'ਤੇ ਸਾਰਿਆਂ ਵਾਸਤੇ ਰੋਟੀ ਤਿਆਰ ਕਰਦੀ ਹਾਂ ਸਿਲਵੱਟੇ 'ਤੇ ਚਟਨੀ ਬਣਾਉਂਦੀ ਹਾਂ ਅਤੇ ਸਾਰਿਆਂ ਨੂੰ ਖਵਾਉਂਦੀ ਹਾਂ ਫਿਰ ਘਰ ਦਾ ਕੰਮ ਕਾਰ ਨਬੇੜ ਕੇ ਦੁਬਾਰਾ ਉਸ ਪੇੜ ਦੀ ਛਾਂ ਥੱਲੇ ਬੈਠ ਜਾਂਦੀ ਹਾਂ ਧੁੱਪ ਤਿੱਖੀ ਹੈ ਪਰ ਫਿਰ ਵੀ ਗਰਮੀ ਮਹਿਸੂਸ ਨਹੀਂ ਹੋ ਰਹੀ ਮੇਰੇ ਹੱਥ ਵਿੱਚ ਮੋਬਾਇਲ ਨਹੀਂ ਹੈ ਰੀਲਾਂ ਵੇਖਣ ਵਾਸਤੇ ਪਰ ਮੇਰੇ ਹੱਥ ਵਿੱਚ ਇੱਕ ਸੋਹਣੀ ਜਿਹੀ ਚੁੰਨੀ ਹੈ ਜਿਸ ਦੇ ਉੱਪਰ ਮੈਂ ਫੁਲਕਾਰੀ ਦੇ ਫੁੱਲ ਕੱਢ ਰਹੀ ਹਾਂ ਔਰ ਆਪਣੇ ਲਈ ਇੱਕ ਸੋਹਣੀ ਜਿਹੀ ਚੁੰਨੀ ਤਿਆਰ ਕਰ ਰਹੀ ਹਾਂ ਮੇਰੇ ਬੱਚੇ ਆ ਗਏ ਹਨ ਸਕੂਲ ਤੋਂ ਬੈਠੇ ਹਨ ਮੇਰੇ ਕੋਲ ਪਰ ਉਹਨਾਂ ਦੇ ਹੱਥ ਵਿੱਚ ਵੀ ਮੋਬਾਇਲ ਨਹੀਂ ਹੈ ਉਹ ਮੇਰੇ ਨਾਲ ਬੈਠ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਹਨ ਅਤੇ ਮੈਨੂੰ ਇੰਨਾ ਅੱਛਾ ਮਹਿਸੂਸ ਹੋ ਰਿਹਾ ਹੈ ਅਤੇ ਕਿਸੇ ਟੈਕਨੋਲੋਜੀ ਦੀ ਕਿਸੇ ਚੀਜ਼ ਦੀ ਥੁੜ ਔਰ ਘਾਟ ਮਹਿਸੂਸ ਨਹੀਂ ਹੋ ਰਹੀ